ਮੈਂ ਅੰਗਰੇਜ਼ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੋ ਕਿ ਮੈਂ ਕਾਫੀ ਸਮੇਂ ਤੋਂ ਸ਼ਹਿਰ ਬਰਨਾਲੇ ਦੇ ਵਿੱਚ ਡਾਂਸਿੰਗ ਡਾਂਸਿੰਗ ਸਕੂਲ ਦੇ ਵਿੱਚ ਲੱਗਿਆ ਹੋਇਆ ਹਾਂ ਡਾਂਸਿੰਗ ਸਕੂਲ ਦੇ ਵਿੱਚ ਪਹੁੰਚ ਕੇ ਸਾਨੂੰ ਕਿਉਂਕਿ ਸਾਡੇ ਸੀਨੀਅਰ ਡਾਂਸਿੰਗ ਦੇ ਬਾਰੇ ਦੱਸਦੇ ਹਨ ਡਾਂਸਿੰਗ ਕਰਨ ਸਮੇਂ ਜੋ ਕਿ ਸਾਡਾ ਸਰੀਰ ਸਾਰਾ ਹੀ ਹਿਲਜੁਲ ਕਰਦਾ ਹੈਗਾ ਡਾਂਸਿੰਗ ਦੇ ਨਾਲ ਨਾਲ ਸਾਡਾ ਸਰੀਰ ਜੋ ਕਿ ਆਪਣੀ ਕਸਰਤ ਵੀ ਕਰਦਾ ਹੈਗਾ ਕਿਉਂਕਿ ਸਾਡੇ ਸਰੀਰ ਦੇ ਅੰਗ ਅੰਗ ਆਪਣਾ ਆਪਣਾ ਕੰਮ ਕਰਦੇ ਹਨ ਇਸਦੇ ਨਾਲ ਸਾਨੂੰ ਖੁਸ਼ੀ ਵੀ ਮਿਲਦੀ ਹੈ ਅਤੇ ਨਾਲੇ ਅਸੀਂ ਡਾਂਸਿੰਗ ਦਾ ਆਨੰਦ ਵੀ ਮਾਣ ਲੈਂਦੇ ਹਾਂ ਡਾਂਸਿੰਗ ਜਿਵੇਂ ਆਪਣੇ ਆਮ ਤੌਰ 'ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਡਾਂਸਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਸਮੇਂ ਵੀ ਆਪਣਾ ਸਰੀਰ ਸਾਰਾ ਕਸਰਤ ਹੁੰਦਾ ਹੈ ਡਾਂਸਿੰਗ ਦੇ ਨਾਲ ਕਿਉਂਕਿ ਆਪਾਂ ਹਿਲਜੁਲ ਕਰਦੇ ਹਾਂ ਕਸਰਤ ਦੇ ਹਿਸਾਬ ਨਾਲ ਹੀ ਆਪਣਾ ਸਰੀਰ ਹਿਲਜੁਲ ਕਰਦਾ ਹੈਗਾ ਇਸ ਨੂੰ ਆਪਾਂ ਡਾਂਸਿੰਗ ਕਹਿੰਦੇ ਹਾਂ ਡਾਂਸਿੰਗ ਦੇ ਨਾਲ ਨਾਲ ਆਪਾਂ ਲੋਕਾਂ ਦੀ ਖੁਸ਼ੀ ਵੀ ਸ਼ਾਮਿਲ ਕਰ ਲੈਂਦੇ ਹਾਂ ਔਰ ਆਪਣੇ ਖੁਸ਼ੀ ਵੀ ਲੋਕਾਂ ਦੇ ਵਿੱਚ ਸਾਂਝੀ ਕਰ ਸਕਦੇ ਹਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਹੋਰ ਕੋਈ ਪ੍ਰੋਗਰਾਮ ਜਾਂ ਜਸ਼ਨ ਮਨਾਇਆ ਜਾਂਦਾ ਸਕੂਲਾਂ ਦੇ ਵਿੱਚ ਸਾਲ ਬਾਅਦ ਫੰਕਸ਼ਨ ਕਰਵਾਇਆ ਜਾਂਦਾ ਹੈ ਉੱਥੇ ਵੀ ਡਾਂਸਿੰਗ ਦਾ ਲਾਭ ਉਠਾਇਆ ਜਾਂਦਾ ਹੈ